ਮਿਊਚਲ ਫੰਡ ਪੈਸੇ ਦਾ ਇੱਕ ਪੂਲ ਹੁੰਦਾ ਹੈ ਜੋ ਕਿ ਇੱਕ ਫੰਡ ਮੇਨੇਜਰ ਦੁਆਰਾ ਚਲਾਇਆ ਜਾਂਦਾ ਹੈ ਇਹ ਇੱਕ ਟਰੱਸਟ ਹੈ ਜੋ ਬਹੁਤ ਸਾਰੇ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਕੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਭੂਤੀਆਂ ਜਿਵੇਂ ਕਿ ਇਕੁਅਟੀ ਬੋਂਡ ਮਨੀ ਮਾਰਕੀਟ ਯੰਤਰ ਆਦਿ ਖਰੀਦਦਾ ਹੈ ਮਿਊਚੁਅਲ ਫੰਡ ਆਮ ਤੌਰ 'ਤੇ ਚਾਰ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਬੋਂਡ ਫੰਡ ਮਨੀ ਮਾਰਕੀਟ ਫੰਡ ਟਾਰਗੇਟ ਡੇਟ ਫੰਡ ਅਤੇ ਸਟੋਕ ਫੰਡ ਹਰ ਤਰ੍ਹਾਂ ਦੇ ਮਿਊਚਅਲ ਫੰਡਾਂ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਜੋ ਕੰਮ ਅਤੇ ਵਾਪਸੀ ਦੀ ਸੰਭਾਵਨਾ ਹੁੰਦੀ ਹੈ ਜੋ ਨਿਵੇਸ਼ਕਾਂ ਨੂੰ ਆਪਣੇ ਵਿੱਤੀ ਉਦੇਸ਼ਾਂ ਅਤੇ ਜੋਖਮ ਸਹਿਨਸ਼ੀਲਤਾ ਦੇ ਆਧਾਰ 'ਤੇ ਚੋਣ ਕਰਨ ਦੀ ਆਗਿਆ ਦਿੰਦੀ ਹੈ ਮਿਊਚੁਅਲ ਫੰਡਾਂ ਦੇ ਬਹੁਤ ਫ਼ਾਇਦੇ ਹਨ ਜਿਵੇਂ ਕਿ ਵਿਭਿੰਨਤਾ ਪੇਸ਼ੇਵਰ ਪ੍ਰਬੰਧਨ ਰੁਪਏ ਦੀ ਔਸਤ ਲਾਗਤ ਟੈਕਸ ਲਾਭ ਅਤੇ ਹੋਰ ਵੀ ਕਈ ਲਾਭ ਹੁੰਦੇ ਹਨ ਇਸ ਕਰਕੇ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ ਜੋ ਲੋਕ ਆਪਣੀ ਦੌਲਤ ਵਧਾਉਣਾ ਚਾਹੁੰਦੇ ਹਨ ਅਤੇ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਲੋਕਾਂ ਦਾ ਮਾਰਗਦਰਸ਼ਨ ਕਰਨ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਫੰਡ ਨਿਵੇਸ਼ਕਾਂ ਨੂੰ ਆਪਣੇ ਨਿਵੇਸ਼ਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਪੇਸ਼ੇਵਰ ਫੰਡ ਪ੍ਰਬੰਧਨ ਤੋਂ ਲਾਭ ਪ੍ਰਾਪਤ ਕਰਨ ਦਾ ਇੱਕ ਤਰੀਕਾ ਪ੍ਰਦਾਨ ਕਰਦੇ ਹਨ